ਮੈਂ ਵਰਿੰਦਰ ਕੁਮਾਰ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਨੂੰ ਮੇਰੇ ਦੋਸਤ ਨੇ ਦੱਸਿਆ ਕਿ ਆਪਣੀ ਰਸੋਈ ਤੋਂ ਬੜਾ ਹੀ ਵਧੀਆ ਖਾਣਾ ਮਿਲਦਾ ਹੈ ਮੈਂ ਉਸ ਦੇ ਕਹਿਣ 'ਤੇ ਜਦੋਂ ਤੁਹਾਨੂੰ ਮੀਨੂ ਮੁਤਾਬਕ ਆਰਡਰ ਦਿੱਤਾ ਤਾਂ ਮੈਂ ਸੋਚਿਆ ਕਿ ਮੈਨੂੰ ਬੜਾ ਹੀ ਵਧੀਆ ਅਤੇ ਲਜ਼ੀਜ ਖਾਣਾ ਆਏਗਾ ਪਰ ਜਦੋਂ ਮੈਂ ਦੇਖਿਆ ਕਿ ਮੈਂ ਤਾਂ ਆਰਡਰ ਪੂਰੀਆਂ ਚਨੇ ਆਦਿ ਦਾ ਦਿੱਤਾ ਸੀ ਪਰ ਮੈਨੂੰ ਤੁਸੀਂ ਪੈਕਿੰਗ ਵਿੱਚ ਪੀਜ਼ਾ ਬਰਗਰ ਆਦਿ ਭੇਜ ਦਿੱਤਾ ਹੈ ਮੈਂ ਆਪਣੇ ਆਰਡਰ ਨੂੰ ਦੇਖਿਆ ਤਾਂ ਉਸ ਸਮੇਂ ਹੀ ਮੇਰੇ ਚਿ ਮੇਰਾ ਚਿਹਰਾ ਇੱਕਦਮ ਉਦਾਸ ਹੋ ਗਿਆ ਅਤੇ ਮੈਂ ਮਨ ਵਿੱਚ ਇਹ ਸੋਚਿਆ ਕਿ ਇਹ ਮੇਰੇ ਆਰਡਰ ਮੁਤਾਬਕ ਖਾਣਾ ਗਲਤ ਆ ਗਿਆ ਹੈ ਇਸ ਕਰਕੇ ਮੈਂ ਤੁਹਾਡੇ ਰੈਸਟੋਰੈਂਟ ਆਪਣੀ ਰਸੋਈ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਖਾਣਾ ਮੈਨੂੰ ਮੇਰੇ ਕਹਿਣ ਮੁਤਾਬਕ ਨਹੀਂ ਮਿਲਿਆ ਮੈਂ ਇਹ ਖਾਣਾ ਵਾਪਸ ਭੇਜ ਰਿਹਾ ਹਾਂ ਇਸ ਲਈ ਕਿਰਪਾ ਕਰਕੇ ਮੈਂ ਜਿੰਨਾ ਵੀ ਭੁਗਤਾਨ ਕੀਤਾ ਹੈ ਉਹ ਕਿਰਪਾ ਕਰਕੇ ਮੈਨੂੰ ਵਾਪਸ ਕਰ ਦਿਓ ਤਾਂ ਕਿ ਮੈਂ ਤੁਹਾਡੇ ਆਦਿ ਭੇਜੇ ਭੇਜਤਾ ਜਦੋਂ ਮੈਂ ਆਪਣੇ ਆਡਰ ਨੂੰ ਦੇਖਿਆ ਤਾਂ ਉਸ ਸਮੇਂ ਹੀ ਮੇਰਾ ਚਿਹਰਾ ਇੱਕਦਮ ਉਦਾਸ ਹੋ ਗਿਆ ਮੇਰੇ ਮਨ ਵਿੱਚ ਇਹ ਸੋਚਿਆ ਕਿ ਇਹ ਮੇਰੇ ਆਡਰ ਮੁਤਾਬਕ ਖਾਣਾ ਗਲਤ ਆ ਗਿਆ ਹੈ ਇਸ ਕਰਕੇ ਮੈਂ ਤੁਹਾਡੇ ਰੈਸਟੋਰੈਂਟ ਆਪਣੀ ਰਸੋਈ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਖਾਣਾ ਮੇਰੇ ਮੁਤਾਬਕ ਨਹੀਂ ਮਿਲਿਆ ਅਤੇ ਮੈਂ ਇਹ ਖਾਣਾ ਵਾਪਸ ਭੇਜ ਰਿਹਾ ਹਾਂ ਇਸ ਲਈ ਕਿਰਪਾ ਕਰਕੇ ਮੇਰਾ ਜਿੰਨਾ ਭੁਗਤਾਨ ਭੁਗਤਾਨ ਕੀਤਾ ਹੈ ਉਹ ਕਿਰਪਾ ਕਰਕੇ ਵਾਪਸ ਕਰ ਦਿਓ ਅੰਤ ਵਿੱਚ ਮੈਂ ਇਹ ਦੱਸਾਂਗਾ ਕਿ ਤੁਹਾਡੇ ਰੈਸਟੋਰੈਂਟ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜਦੋਂ ਵੀ ਤੁਹਾਨੂੰ ਕਿਸੇ ਵੀ ਇਨਸਾਨ ਜਾਂ ਆਦਮੀ ਦਾ ਆਰਡਰ ਆਵੇ ਤਾਂ ਤੁਸੀਂ ਉਸ ਨੂੰ ਮੀਨੂ ਮੁਤਾਬਕ ਖਾਣਾ ਭੇਜੋ ਤਾਂ ਕਿ ਤੁਹਾਡੇ ਰੈਸਟੋਰੈਂਟ ਦੀ ਚੜ੍ਹਤ ਕਾਫੀ ਮਸ਼ਹੂਰੀ ਉਸ ਦੀ ਐਡ ਹੋ ਸਕੇ ਮੈਂ ਇਸ ਕੰਮ ਲਈ ਤੁਹਾਨੂੰ ਵਧੀਆ ਮੈਨੇਜਮੈਂਟ ਕਰਨ ਦੀ ਸਲਾਹ ਦਿੰਦਾ ਹਾਂ